ਪੰਦਰ੍ਹਾਂ ਹਜ਼ਾਰ ਸੋਲ੍ਹਾਂ ਹਜ਼ਾਰ ਚਾਰ ਸੌ ਚੌਂਹਠ ਇੱਕ ਲੱਖ ਦੋ ਹਜ਼ਾਰ ਪੰਜ ਸੌ ਪਚਵੰਜਾ ਛੇ ਹਜ਼ਾਰ ਸੱਤ ਸੌ ਉੱਨੀ ਤੇਰ੍ਹਾਂ ਹਜ਼ਾਰ ਸੱਤ ਸੌ ਅੱਸੀ